ਆਪਣਾ ਸੱਭਿਆਚਾਰ ਵਿਰਾਸਤ ਨੂੰ ਸਾਂਭਣ ਵਾਸਤੇ ਸਾਡੇ ਅਨੰਦਪੁਰ ਸਾਹਿਬ ਪੰਥ ਖਾਲਸਾ ਜਿੱਥੇ ਕਲਗੀਧਰ ਪਾਤਸ਼ਾਹ ਨੇ ਸਾਜਿਆ ਉੱਥੇ ਨਿਹੰਗ ਸਿੰਘ ਆਪਣੇ ਜੌਹਰ ਦਿਖਾਉਂਦੇ ਨੇ ਆਪਣਾ ਅਕਾਲੀ ਦਲ ਬੁੱਢਾ ਦਲ ਨਿਹੰਗ ਸਿੰਘ ਆ ਕੇ ਆਪਣੇ ਜੌਹਰ ਦਿਖਾਉਂਦੇ ਨੇ ਘੋੜੇ ਹਾਥੀਆਂ ਸਤਿਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਅਤੇ ਉੱਥੇ ਲਾਇਬ੍ਰੇਰੀਆਂ ਹਨ ਨਗਰ ਕੀਰਤਨ ਸਤਿਗੁਰ ਮਹਾਰਾਜ ਦੀ ਕਿਰਪਾ ਦੇ ਨਾਲ ਨਿਕਲਦਾ ਹੈ ਵਿਰਾਸਤ ਏ ਖਾਲਸਾ ਜੋ ਸਾਡੇ ਪੰਜਾਬੀ ਸੱਭਆਚਾਰ ਦੇ ਨਾਲ ਵੀ ਜੁੜਿਆ ਹੋਇਆ ਹੈ ਅਤੇ ਸਾਡੀ ਜਿਹੜੀ ਇੱਕ ਪੰਜਾਬੀ ਮਾਂ ਬੋਲੀ ਹੈ ਉਹ ਵੀ ਇਹਦੇ ਨਾਲ ਜੁੜੀ ਹੋਈ ਹੈ ਪੰਥ ਖਾਲਸੇ ਦੇ ਨਾਲ ਜੋ ਅਸੀਂ ਉਹਨੂੰ ਭੁੱਲ ਚੁੱਕੇ ਹਾਂ ਸੌ ਸਤਿਗੁਰ ਮਹਾਰਾਜ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਵਿਰਾਸਤ ਏ ਖਾਲਸਾ ਇਤਹਾਸ ਨੂੰ ਦਰਸਾਉਂਦਾ ਹੈ ਸਤਿਗੁਰ ਮਹਾਰਾਜ ਨੇ ਵੀ ਬੜੀ ਕਿਰਪਾ ਕੀਤੀ ਹੈ ਸਾਡੇ 'ਤੇ ਪਰ ਅਸੀਂ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਬੋਲੀ ਹੈ ਅਸੀਂ ਇਹਨੂੰ ਭੁੱਲਦੇ ਜਾ ਰਹੇ ਹਾਂ ਅਸੀ ਅੱਜ ਦੇ ਟਾਈਮ 'ਚ ਆਪਣੇ ਬੱਚਿਆ ਨੂੰ ਬਾਹਰ ਭੇਜ ਰਹੇ ਹਾਂ ਆਪਣੇ ਵਿਰਸੇ ਤੋਂ ਦੂਰ ਕਰ ਰਹੇ ਹਾਂ ਕਿਉਂ ਨਾ ਆਪਾਂ ਇੱਥੇ ਹੀ ਆਪਣੇ ਬੱਚਿਆਂ ਨੂੰ ਇੱਕ ਵਿਰਸੇ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਿਆ ਜਾਵੇ ਅਤੇ ਇੱਥੇ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਅਨੇਕਾਂ ਪ੍ਰਕਾਰ ਦੇ ਸਮਾਗਮ ਮਨਾਏ ਜਾਂਦੇ ਨੇ ਜਿੱਥੇ ਇਤਹਾਸ ਦੇ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਸੱਭਿਆਚਰ ਦੇ ਨਾਲ ਜੋੜਿਆ ਜਾਂਦਾ ਹੈ ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਨੇ ਉਹਦੇ ਨਾਲ ਜੋੜਿਆ ਜਾਂਦਾ ਹੈ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਸੀ ਕਿਸੇ ਟੈਮ ਦੇ ਵਿੱਚ ਕਿੰਨਾ ਪਿਆਰ ਹੁੰਦਾ ਸੀ ਇਕੱਠੇ ਰਹਿੰਦੇ ਸੀ ਇੱਕ ਜਿਹੜੀ ਇੱਕ ਪਰਿਵਾਰ ਹੁੰਦਾ ਸੀ ਇੱਕ ਬੂਟਾ ਹੁੰਦਾ ਸੀ ਅੱਜ ਅੱਜ ਦਾ ਟੈਮ ਜੋ ਅੱਜ ਦਾ ਦੋਰ ਸਾਡਾ ਚੱਲ ਰਿਹਾ ਅਸੀਂ ਇੱਕ ਘਰ ਦੇ ਵਿੱਚ ਰਹਿ ਕੇ ਵੀ ਅਸੀਂ ਵੱਖ ਵੱਖ ਰਹਿ ਰਹੇ ਹਾਂ ਸਾਡੇ 'ਚ ਜਿਹੜੀ ਪਿਆਰ ਦੀ ਪਿਆਰ ਦੀ ਛਵੀ ਹੈ ਉਹ ਕਿਤੇ ਨਾ ਕਿਤੇ ਦੂਰ ਹੋ ਚੱਲੀ ਹੈ ਸਿਰਫ ਅਸੀਂ ਇੱਕ ਆਪਣਾ ਪੜ੍ਹਿਆ ਲਿਖਿਆ ਦੌਰ ਕਹਿ ਲਉ ਜਾਂ ਬਾਹਰ ਦੇ ਅਸੀਂ ਬਾਹਰ ਦੇ ਮਾਹੌਲ ਦੇ ਨਾਲ ਅਸੀਂ ਮਤਲਬ ਇੰਨੇ ਕੁ ਸੂਝਵਾਨ ਹੋ ਗਏ ਹਾਂ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ 'ਤੇ ਅਤੇ ਪੰਜਾਬ ਦੀ ਧਰਤੀ ਸਮਾਗਮਾਂ ਵਿੱਚ ਸੰਗਤਾਂ ਨੂੰ ਉਤਸ਼ਾਹ ਕੀਤਾ ਜਾਂਦਾ ਹੈ ਕਿ ਆਪਣੇ ਧਾਰਮਿਕ ਸੱਭਿਆਚਾਰ ਦੇ ਨਾਲ ਜੋੜ ਕੇ ਜੋੜ ਸਕੀਏ ਅਤੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਆਉਣ ਵਾਲੀ ਪੀੜ੍ਹੀ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਪੁਰਾਣੀਆਂ ਚੀਜ਼ਾਂ ਬਾਰੇ ਪਤਾ ਲੱਗੇ ਸਾਡੇ ਸੱਭਿਆਚਾਰ ਬਾਰੇ ਪਤਾ ਲੱਗੇ ਜੋ ਸਾਡਾ ਪੰਜਾਬੀ ਸੱਭਿਆਚਾਰ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਮਤਲਬ ਧੀਆਂ ਨੇ ਉਹਨਾਂ ਦੇ ਧੀ ਤੀਆਂ ਦੇ ਵਿੱਚ ਮਤਲਬ ਤਿੱਥ ਤਿਉਹਾਰ ਵੀ ਮਨਾਏ ਜਾਂਦੇ ਨੇ ਅਤੇ ਜਿੱਦਾਂ ਮਤਲਬ ਸੰਧਾਰੇ ਵਗੈਰਾ ਦਿੰਦੇ ਨੇ ਉਹਨਾਂ ਦੇ ਨਾਲ ਵੀ ਜੁੜੀਆਂ ਹੋਈਆਂ ਸੱਭਿਆਚਾਰਕ ਹੁੰਦੀਆਂ ਨੇ ਜੋ ਪੇਕੇ ਘਰ ਆ ਕੇ ਹੈ ਨਾ ਧੀਆਂ ਆਪਣੇ ਮਤਲਬ ਜਿਹੜੇ ਚਾਅ ਲੋੜ ਨੇ ਲਾਡ ਨੇ ਉਹ ਪੂਰੇ ਕਰਦੀਆਂ ਨੇ ਉਹ ਵੀ ਸਾਡੇ ਪੰਜਾਬੀ ਸੱਭਿਆ ਦੇ ਦਾਰ ਦੇ ਨਾਲ ਜੁੜੀਆਂ ਹੋਈਆਂ ਨੇ